ਪੰਜਾਬੀ ਭਾਸ਼ਾ ਦੀ ਵਰਤੋਂ ਹੈ ਜਿਹੜੀ ਉਹ ਵਣਜ ਵਪਾਰ ਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਹੀ ਕੀਤੀ ਜਾਂਦੀ ਹੈ ਜਿਵੇਂ ਕਿ ਆਪਾਂ ਦੇਖੀਏ ਕੋਟ ਕਚਹਿਰੀਆਂ ਨੇ ਕੋਟ ਕਚਹਿਰੀਆਂ ਦੇ ਵਿੱਚ ਜਿੰਨੇ ਵੀ ਟਾਈਪਿਸਟ ਨੇ ਸਟੈਨੋ ਨੇ ਉਹ ਸਾਰਾ ਕੰਮ ਜੋ ਲਿਖਤੀ ਕਰਦੇ ਨੇ ਉਹ ਪੰਜਾਬੀ ਦੇ ਵਿੱਚ ਹੀ ਕਰਦੇ ਨੇ ਜਿਹਦੇ ਨਾਲ ਕਿ ਰੁਜ਼ਗਾਰ ਵੱਧਦੇ ਨੇ ਲੋਕਾਂ ਨੂੰ ਰੁਜ਼ਗਾਰ ਮਿਲਦੇ ਨੇ ਪੰਜਾਬੀ ਭਾਸ਼ਾ ਦੇ ਪੋਸਟਾਂ ਨਿਕਲਦੀਆਂ ਸਰਕਾਰੀ ਸਟੈਨੋਗ੍ਰਾਫਰ ਦੀਆਂ ਨਿਕਲਦੀਆਂ ਨੇ ਉਹ ਵੀ ਰੱਖੇ ਜਾਂਦੇ ਨੇ ਪੰਜਾਬੀ ਟਾਈਪਿੰਗ ਵਾਲੇ ਰੱਖੇ ਜਾਂਦੇ ਨੇ ਅਤੇ ਜਿੰਨੇ ਵੀ ਡਾਕੂਮੈਂਟ ਆ ਕੋਈ ਵਪਾਰ ਕਰਦਾ ਕੋਈ ਕਿਸੇ ਤੋਂ ਚੀਜ਼ ਲੈਂਦਾ ਜਾਂ ਵੇਚਦਾ ਗਾ ਉਹ ਵੀ ਸਾਰੇ ਡਾਕੂਮੈਂਟ ਪੰਜਾਬੀ ਦੇ ਵਿੱਚ ਹੀ ਲਿਖੇ ਜਾਂਦੇ ਨੇ ਤਾਂ ਕਿ ਜਿਹੜੇ ਲੋਕ ਉਹਨੂੰ ਆਸਾਨੀ ਨਾਲ ਪੜ੍ਹ ਸਕਣ ਜਿਹੜੇ ਪੰਜਾਬੀ ਵਾਲੇ ਨੇ ਅਤੇ ਇਸ ਤਰ੍ਹਾਂ ਨਾ ਹੋਵੇ ਵੀ ਮਤਲਬ ਆਮ ਲੋਕਾਂ ਨੂੰ ਸਮਝ ਨਾ ਆਵੇ ਭਾਸ਼ਾ ਅਤੇ ਹੋਰ ਕੰਮ ਜਿਹੜੇ ਨੇ ਪੰਜਾਬੀ ਦੇ ਵਿੱਚ ਜਿਹੜਾ ਆਮ ਵਪਾਰ ਆ ਬਾਜ਼ਾਰਾਂ ਦਾ ਉਹ ਵੀ ਪੰਜਾਬੀ ਬੋਲ ਕੇ ਹੀ ਕੀਤਾ ਜਾਂਦਾ ਕਿਉਂਕਿ ਲੋਕ ਪੰਜਾਬੀ ਬੋਲਦੇ ਨੇ ਦੂਜੇ ਲੋਕ ਵੀ ਆਸਾਨੀ ਨਾਲ ਹੀ ਸਿੱਖ ਜਾਂਦੇ ਇੱਕ ਦੂਜੇ ਦੀ ਭਾਸ਼ਾ ਜਦੋਂ ਕੋਈ ਚੀਜ਼ ਆਪਾਂ ਇੱਕ ਦੂਜੇ ਸਟੇਟ ਤੋਂ ਲੈਂਦੇ ਹਾਂ ਜਾਂ ਹਾਂ ਇੱਕ ਦੂਜੇ ਨਾਲ ਆਪਾਂ ਬੋਲ ਕੇ ਗੱਲ ਕਰਦੇ ਹਾਂ ਤਾਂ ਉਹ ਵੀ ਆਸਾਨੀ ਨਾਲ ਸਿੱਖ ਜਾਂਦਾ ਬੰਦਾ ਤਾਂ ਬਹੁਤ ਲੋਕ ਪੰਜਾਬੀ ਦੇ ਵਿੱਚ ਹੀ ਬੋਲਦੇ ਨੇ ਪੰਜਾਬੀ ਦੇ ਵਿੱਚ ਹੀ ਵਪਾਰ ਕਰਦੇ ਨੇ ਇੱਕ ਦੂਜੇ ਤੋਂ ਲੈਂਦੇ ਆ ਚੀਜ਼ ਵੇਚਦੇ ਆ ਕੁਛ ਲਿਖਤੀ ਚੀਜ਼ਾਂ ਵੀ ਨੇ ਜਿਹੜੇ ਆ ਲਗਾਉਣੇ ਪੈਂਦੇ ਨੇ ਜੋ ਉਹ ਡਾਕੂਮੈਂਟ ਪਰਨੋਟ ਵਗੈਰਾ 'ਤੇ ਹੋ ਜਾਂਦੀਆਂ ਨੇ ਕੁਝ ਚੀਜ਼ਾਂ ਊਂ ਵੀ ਹੋਈ ਜੁਬਾਨੀ ਦੇ ਵਿੱਚ ਵੀ ਹੋ ਜਾਂਦੀਆਂ ਨੇ ਮੂੰਹ ਜੁਬਾਨੀ ਹੋ ਜਾਂਦੀਆਂ ਨੇ